ਹੈਲੋ ਹਾਂਜੀ ਸਰ ਹਰਿਮੰਦਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਬੋਲ ਰਹੇ ਆ ਜੀ ਹਾਂਜੀ ਵਾਹਿਗੁਰੂ ਜੀ ਮੈਂ ਉੱਥੋਂ ਰਾਜਸਥਾਨ ਤੋਂ ਆਉਣਾ ਸੀ ਦਰਸ਼ਨਾਂ ਵਾਸਤੇ ਹਾਂਜੀ ਅਤੇ ਮੈਂ ਸੇਵਾ ਕਰਨੀ ਚਾਹੁੰਦਾ ਇੱਥੇ ਲੰਗਰ ਦੇ ਵਿੱਚ ਅਤੇ ਇਹਦੇ ਵਿੱਚ ਕੀ ਗੱਲ ਮੈਨੂੰ ਪੈਸੇ ਦੇਣੇ ਪੈਣਗੇ ਕਿ ਜਾਂ ਮੈਂ ਰਸਦ ਵਗੈਰਾ ਵੀ ਚੜ੍ਹਾ ਸਕਦਾ ਹਾਂ ਅੱਛਾ ਇੱਕ ਗੱਲ ਹੋਰ ਮੈਂ ਇੱਥੇ ਰਹਿ ਕੇ ਕੁਝ ਦਿਨ ਸੇਵਾ ਵੀ ਕਰਨਾ ਚਾਹੁੰਦਾ ਆਪਣੇ ਹੱਥਾਂ ਦੇ ਨਾਲ ਅਤੇ ਮੈਨੂੰ ਰਹਿਣ ਵਾਸਤੇ ਕਮਰਾ ਵਗੈਰਾ ਮਿਲ ਜਾਵੇਗਾ ਉੱਥੇ ਆਪਣੇ ਖਾਣ ਪੀਣ ਦਾ ਹਾਂਜੀ ਲਾਗੇ ਬੰਨੇ ਦਰਸ਼ਨਾਂ ਵਾਸਤੇ ਜਾਣ ਵਾਸਤੇ ਤੁਹਾਡੇ ਕੋਲ ਕੋਈ ਸੇਵਾ ਦਾ ਪ੍ਰਬੰਧ ਹੈ ਕੋਈ ਗੱਡੀ ਦਾ ਜਾਂ ਹੋਰ ਕਿਸੇ ਚੀਜ਼ ਦਾ ਲੰਗਰ ਚੌਵੀ ਘੰਟੇ ਚੱਲਦਾ ਜੀ ਠੀਕ ਹੈ ਵਾਹਿਗੁਰੂ ਜੀ ਮਿਹਰਬਾਨੀ ਜੀ ਓਕੇ